ਸਤਿ ਸ਼੍ਰੀ ਅਕਾਲ ਜੀ ਤੁਸੀਂ ਰਾਜਾ ਰੈਸਟੋਰੈਂਟ ਤੋਂ ਗੱਲ ਕਰਦੇ ਹੋ ਮੈਂ ਅੱਜ ਰਾਤ ਨੂੰ ਆਪਣੇ ਪਰਿਵਾਰ ਨਾਲ਼ ਤੁਹਾਡੇ ਇੱਥੇ ਰੋਟੀ ਖਾਣ ਦਾ ਪ੍ਰੋਗਰਾਮ ਬਣਾਇਆ ਹੋਇਆ ਹੈ ਅਸੀਂ ਦਸ ਲੋਕ ਹਨ ਮੈਨੂੰ ਮੇਰੀ ਸਹੇਲੀ ਨੇ ਤੁਹਾਡੇ ਰੈਸਟੋਰੈਂਟ ਬਾਰੇ ਦੱਸਿਆ ਸੀ ਕਿ ਤੁਹਾਡਾ ਖਾਣਾ ਬਹੁਤ ਵਧੀਆ ਅਤੇ ਸਵਾਦਇਸ਼ਟ ਹੁੰਦਾ ਹੈ ਕਿਉਂਕਿ ਮੈਂ ਇਥੇ ਆਪਣੇ ਪਰਿਵਾਰ ਨਾਲ਼ ਨਵੀਂ ਰਹਿਣ ਆਈ ਹੋਈ ਹਾਂ ਤੁਸੀਂ ਮੈਨੂੰ ਇਸ ਗੱਲ ਦੀ ਜਾਣਕਾਰੀ ਦੇ ਸਕਦੇ ਹੋ ਕਿ ਅਗਰ ਮੈਂ ਤੁਹਾਡੇ ਰੈਸਟੋਰੈਂਟ ਵਿੱਚ ਆਪਣਾ ਟੇਬਲ ਹੁਣ ਬੁੱਕ ਕਰਵਾਉਂਦੀ ਹਾਂ ਤਾਂ ਕੀ ਤੁਸੀਂ ਮੈਨੂੰ ਕੋਈ ਡਿਸਕਾਊਂਟ ਦਵੋਗੇ ਜਾਂ ਫਿਰ ਕੋਈ ਸਪੈਸ਼ਲ ਪੇਸ਼ਕਸ਼ ਜਾਂ ਫਿਰ ਕੋਈ ਬਿੱਲ ਵਿੱਚ ਡਿਸਕਾਊਂਟ ਜਾਂ ਮਿੱਠੇ ਵਿੱਚ ਕੋਈ ਐਕਸਟਰਾ ਡਿਸ਼ ਦਵੋਗੇ